ਮੈਂ ਬਹੁਤ ਸਕੂਲ ਵਿੱਚ ਕਾਲਜਾਂ ਵਿੱਚ ਭਾਰਤੀ ਵਿਗਿਆਨੀਆਂ ਬਾਰੇ ਪੜ੍ਹਿਆ ਹੈ ਜਿਨ੍ਹਾਂ ਵਿੱਚੋਂ ਏ ਪੀ ਜੇ ਅਬਦੁਲ ਕਲਾਮ ਉਨਾਂ ਵਿੱਚੋਂ ਇੱਕ ਹੈ ਅਤੇ ਇਹ ਬਹੁਤ ਹੀ ਜ਼ਿਆਦਾ ਤਕੜੇ ਵਿਗਿਆਨੀ ਰਹੇ ਹੈ ਇਹਨਾਂ ਨੇ ਭਾਰਤ ਇਹਨਾਂ ਦਾ ਭਾਰਤ ਵਿੱਚ ਬਹੁਤ ਬੜਾ ਹੱਥ ਹੈ ਇਹਨੇ ਬਹੁਤ ਹੀ ਜ਼ਿਆਦਾ ਬੰਬ ਬਣਾਉਣ 'ਚ ਇਹਨਾਂ ਦੀ ਮਦਦ ਭਾਰਤ ਨੇ ਲੀਤੀ ਹੈ ਅਤੇ ਇਹਨਾਂ ਦਾ ਜਨਮ ਪੰਦਰ੍ਹਾਂ ਅਕਤੂਬਰ ਉੱਨੀ ਸੌ ਇਕੱਤੀ ਵਿੱਚ ਹੋਇਆ ਹੈ ਅਤੇ ਇਹ ਭਾਰਤ ਦੇ ਗਿਆਰਵੇਂ ਪ੍ਰੈਸੀਡੈਂਟ ਵੀ ਰਹੇ ਹੈ ਜੋ ਕਿ ਦੋ ਹਜ਼ਾਰ ਦੋ ਤੋਂ ਲੈ ਕੇ ਦੋ ਹਜ਼ਾਰ ਸੱਤ ਵਿੱਚ ਹੈ ਅਤੇ ਇਹਨਾਂ ਦੀਆਂ ਬਹੁਤ ਸਾਰੀਆਂ ਬੁੱਕਾਂ ਹਨ ਅਤੇ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਅਵਾਰਡ ਵੀ ਮਿਲੇ ਹਨ ਅਤੇ ਇਹਨਾਂ ਨੂੰ ਹਰ ਇੱਕ ਬੱਚਾ ਜਾਣਦਾ ਹੈ ਅਤੇ ਇਹ ਬਹੁਤ ਹੀ ਵਧੀਆ ਵਿਗਿਆਨੀ ਹੈ ਅਤੇ ਇਹਨਾਂ ਨੇ ਭਾਰਤ ਦੇ ਲਈ ਬਹੁਤ ਕੁਝ ਹਾਸਲ ਕੀਤਾ ਹੈ